ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਔਡਰ ਕੀਤਾ ਸੀ ਡਿਲੀਵਰੀ ਦਾ ਜੀ ਤੁਸੀਂ ਕਿੱਥੇ ਕੁ ਪਹੁੰਚ ਗਏ ਜੀ ਅਤੇ ਤੁਸੀਂ ਇੱਥੋਂ ਲਾਈਟਾਂ ਵਾਲੇ ਚੌਂਕ ਤੋਂ ਸਿੱਧੇ ਚੰਡੀਗੜ੍ਹ ਰੋਡ ਆ ਕੇ ਗੁਰੂ ਅੰਗਦ ਨਗਰ ਤਿੰਨ ਨੰਬਰ ਗਲ਼ੀ ਤੋਂ ਰਾਈਟ ਮੁੜ ਕੇ ਅੱਗੇ ਜਾ ਕੇ ਪਹਿਲਾ ਹੀ ਚੁਰਸਤਾ ਜਿੱਥੇ ਆਉਂਦਾ ਉੱਥੋਂ ਆ ਕੇ ਤੁਸੀਂ ਮੈਨੂੰ ਕਾਲ ਕਰ ਲਿਓ ਅਤੇ ਮੈਂ ਤੁਹਾਨੂੰ ਦੱਸਦਾਂਗਾ ਅਤੇ ਉੱਥੇ ਪਹੁੰਚ ਜਾਣਾ ਤੁਸੀਂ ਠੀਕ